ਹਾਂਜੀ ਇੱਕ ਦਿਨ ਨਾ ਮੈਂ ਪ ਆਹ ਆਨਲਾਈਨ ਦੇਖ ਰਹੀ ਸੀ ਮੈਂ ਨਾ ਕੁੜਤੀ ਆਰਡਰ ਕਰਨੀ ਸੀ ਚਾ ਕੁੜਤੀਆਂ ਬਹੁਤ ਵਧੀਆ ਆ ਰਹੀਆਂ ਤੀਆਂ ਔਰ ਰੇਟ ਵੀ ਬਹੁਤ ਜ਼ਿਆਦਾ ਸੀ ਉਹਨਾਂ ਦੇ ਇੱਦਾਂ ਹੀ ਬੈਠੇ ਬੈਠੇ ਨਾ ਮੈਂ ਇੱਕ ਕੁੜਤੀ ਆਰਡਰ ਕੀਤੀ ਗਰੀਨ ਕਲਰ ਦੀ ਸੀ ਕੋਟਨ ਵਿੱਚ ਤਾਂ ਮੇਰੇ ਗਰਮੀਆਂ ਦਾ ਮੌਸਮ ਸੀ ਮੈਨੂੰ ਇੱਦਾਂ ਲੱਗਿਆ ਕਿ ਸਾਨੂੰ ਕੋਟਨ ਦਾ ਕੱਪੜਾ ਵਧੀਆ ਰਹੂਗਾ ਗਰਮੀਆਂ 'ਚ ਮੈਂ ਆਰਡਰ ਕੀਤੀ ਉਹਦਾ ਆਰਡਰ ਨਾ ਔਰ ਅ ਰੇਟ ਵੀ ਉਹਦਾ ਹੈਗਾ ਸੀ ਪੰਦਰਾਂ ਸੌ ਸੀ ਉਹਦਾ ਰੇਟ ਫੇਰ ਵੀ ਮੈਂ ਆਰਡਰ ਕਰਤਾ ਕਿਉੰਕਿ ਦੇਖਣ ਨੂੰ ਵਧੀਆ ਲੱਗਦੀ ਸੀ ਉਹ ਤਾਂ ਫੇਰ ਜਦੋਂ ਕੁਛ ਦਿਨਾਂ ਬਾਅਦ ਨਾ ਆਰਡਰ ਆਇਆ ਜਦ ਉਹਨੂੰ ਦੇਖਿਆ ਖੋਲ੍ਹ ਕੇ ਜੋ ਆਰਡਰ ਕੀਤਾ ਨਾ ਉਹ ਉਹ ਆਰਡਰ ਆਇਆ ਹੀ ਨਹੀਂ ਹੈਗਾ ਨਾ ਤਾਂ ਉਹ ਕੁੜਤੀ ਦਾ ਡਿਜ਼ਾਈਨ ਉਹ ਸੀ ਔਰ ਕਲਰ ਵੀ ਉਹਦਾ ਬਹੁਤ ਜ਼ਿਆਦਾ ਜਿਹੜਾ ਫ਼ੋਨ 'ਚ ਦਿਖਾ ਰਹੇ ਸੀ ਨਾ ਉਹ ਬਹੁਤ ਲਾਈਟ ਔਰ ਪਿਆਰਾ ਕਲਰ ਸੀ ਜਦੋਂ ਘਰ ਆਇਆ ਨਾ ਉਹ ਪਾਰਸਲ ਤਾਂ ਇੰਨਾ ਜ਼ਿਆਦਾ ਡਾਰਕ ਕਲਰ ਸੀ ਫੇਰ ਵੀ ਮੈਂ ਚੱਲੋ ਜਦ ਆਇਆ ਤਾਂ ਰੱਖ ਲਿਆ ਫੇਰ ਜਦੋਂ ਮੈਂ ਉਹਨੂੰ ਵਾਸ਼ ਕੀਤਾ ਹੈ ਨਾ ਉਹਦਾ ਕਲਰ ਸਾਰਾ ਹੀ ਫੇਟ ਹੋ ਗਿਆ ਇੰਨਾ ਜ ਡੱਲ ਹੋ ਗਿਆ ਨਾ ਕੱਪੜਾ ਔਰ ਪਾਉਣਾ ਤਾਂ ਬਹੁਤ ਦੂਰ ਦੀ ਗੱਲ ਉਹ ਦੇਖਣ ਨੂੰ ਵੀ ਚੰਗਾ ਨਹੀਂ ਲੱਗਿਆ ਘਰ ਵਿੱਚ ਕਿਸੇ ਨੇ ਵੀ ਉਹ ਪਸੰਦ ਨਹੀਂ ਕੀਤਾ ਕਹਿ ਰਹੇ ਹੈ ਇੰਨੇ ਪੈਸੇ ਲੱਗੇ ਹੈ ਖਰਾਬ ਕਰਤੇ ਉਹ ਕੁੜਤੀ ਨਾ ਬਿਲਕੁਲ ਬੇਕਾਰ ਕੱਪੜਾ ਹੋ ਗਿਆ ਇਹ ਨਾ ਮੈਂ ਕੁੜਤੀ 'ਤੇ ਪੈਸੇ ਖਰਾਬ ਹੀ ਕੀਤੇ ਹੈ ਉਹ ਮੇਰਾ ਆਨਲਾਈਨ ਐਕਸਪੀਰੀਐਂਸ ਨਾ ਬਹੁਤ ਬੁਰਾ ਰਿਹਾ